ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹ ਕਿ ਅੱਜ ਕੱਲ ਦਾ ਇੰਟਰਨੈਟ ਬਹੁਤ ਤੇਜ਼ ਚੱਲਣ ਲੱਗ ਪਿਆ ਤੇ ਜਿਹੜਾ ਅੱਜ ਕੱਲ ਦਾ ਵਿਦਿਆਰਥੀ ਨੇ ਅੱਜ ਕੱਲ ਦੇ ਬੱਚੇ ਹਨ ਉਹ ਇੰਟਰਨੈਟ ਨੂੰ ਬਹੁਤ ਵਰਤਦੇ ਹਨ ਤੇ ਇੰਟਰਨੈਟ ਤੇ ਸਾਰਾ ਸਾਰਾ ਦਿਨ ਦੇਖਦੇ ਰਹਿੰਦੇ ਹਨ ਕਿ ਅਗਲੀ ਨਵੀਂ ਤਕਨੀਕੀ ਕਿਹੜੀ ਆਏਗੀ ਕਿ ਅਗਲੀ ਨਵੀਂ ਗੱਲ ਆਹ ਚੀਜ਼ ਕੀ ਆਏਗੀ ਜੋ ਸਾਡੇ ਕੰਮ ਨੂੰ ਸੌਖਾ ਕਰ ਸਕੇ ਸੋ ਅਸੀਂ ਆਰਾਮ ਨਾਲ ਆਪਣਾ ਕੰਮ ਕਰ ਸਕੀਏ ਤੇ ਮੈਨੂੰ ਲੱਗਦਾ ਹੈ ਕੀ ਜਿਹੜਾ ਸਭ ਤੋਂ ਜਿਆਦਾ ਜਿਹੜੀ ਚੀਜ਼ ਉਹ ਪ੍ਰਭਾਵ ਪਾਏਗੀ ਉਹ ਹੋਣਗੇ ਰੋਬੋਟਸ ਜਿਹੜੇ ਅੱਜ ਕੱਲ ਜਿਹੜੇ ਸਾਰੇ ਹਿੰਦੁਸਤਾਨ ਵਿੱਚ ਸਾਰੀ ਕੰਟਰੀ ਵਿੱਚ ਲੋਕੀ ਰੋਬੋਟਸ ਤੇ ਕੰਮ ਕਰ ਰਹੇ ਹਨ ਕਿ ਜਿਵੇਂ ਅਸੀਂ ਦੇਖਦੇ ਹੀ ਆ ਦੇਖਦੇ ਹੀ ਆ ਕਿ ਰੋਬੋਟ ਜਿਹੜੇ ਹੁੰਦੇ ਆ ਉਹ ਬਹੁਤ ਕੰਮ ਕਰਨ ਵਾਲੇ ਹੁੰਦੇ ਆ ਉਹਨਾਂ ਵਿੱਚ ਉਹਨਾਂ ਨੂੰ ਸਾਰੀ ਲੈਂਗੁਏਜ ਆਉਂਦੀਆਂ ਹੁੰਦੀਆਂ ਜਿਵੇਂ ਪੰਜਾਬੀ ਅੰਗਰੇਜੀ ਸਾਰੀਆਂ ਭਾਸ਼ਾਵਾਂ ਉਹਨਾਂ ਨੂੰ ਆਉਂਦੀਆਂ ਹੁੰਦੀਆਂ ਤੇ ਉਹਨਾਂ ਨੂੰ ਕੰਮ ਕਰਨਾ ਬਹੁਤ ਸੌਖਾ ਹੁੰਦਾ ਤੇ ਅਸੀਂ ਦੇਖਦੇ ਆਂ ਕਿ ਜਦੋਂ ਹੁਣ ਬਾਹਰਲੇ ਸ਼ਹਿਰਾਂ ਵਿੱਚ ਜਿਵੇਂ ਮੈਂ ਇੰਡੀਆ 'ਚ ਰਹਿਦੀ ਆ ਤੇ ਬਾਹਰਲੇ ਸ਼ਹਿਰਾਂ ਵਿੱਚ ਇੰਡੀਆ ਕਪੂਰਥਲਾ ਵਿੱਚ ਹੈਨੀ ਬਾਹਰਲੇ ਸ਼ਹਿਰਾਂ ਵਿੱਚ ਤੁਸੀਂ ਯੂਕੇ ਦੇਖ ਲੋ ਯੂਕੇ ਵਿੱਚ ਲੋਕੀ ਜੀ ਕੇ ਜਾਹੜੀ ਆਪਣਾ ਸਮਾਨ ਲੈਂਦੇ ਘਰ ਦਾ ਸਮਾਨ ਲੈਂਦੇ ਆ ਤੇ ਉਥੇ ਮਾਲ ਵਿੱਚ ਕੋਈ ਵੀ ਬਿਲਿੰਗ ਕਰਨ ਵਾਸਤੇ ਕੋਈ ਬੰਦਾ ਨਹੀਂ ਹੁੰਦਾ ਉਥੇ ਆਪ ਹੀ ਬਿਲਿੰਗ ਕਰਨੀ ਪੈਂਦੀ ਹੈ ਉਹ ਵੀ ਟੈਕਨੋਲੋਜੀ ਉਥੇ ਬਹੁਤ ਜਿਆਦਾ ਆ ਚੁੱਕੀ ਹ ਤੇ ਦੂਜਾ ਜਿਹੜੇ ਰੋਬੋਟਸ ਨੇ ਹੁਣ ਜਿਹੜੇ ਚਾਈਨਾ ਵਿੱਚ ਰੋਬੋਟਸ ਵਗੈਰਾ ਜਿਹੜੇ ਕੰਮ ਕਰਨ ਲੱਗ ਪਏ ਨੇ ਉਹਨਾਂ ਨੇ ਕੰਮ ਲੋਕਾਂ ਤੋਂ ਬਹੁਤ ਸੌਖਾ ਕਰ ਦਿੱਤਾ ਬਟ ਹਾਂ ਇਹਦਾ ਇੱਕ ਨੁਕਸਾਨ ਇਹ ਵੀ ਹੈ ਕਿ ਲੋਕਾਂ ਨੂੰ ਕੰਮ ਕਰਨ ਵਾਸਤੇ ਕੋਈ ਜਗ੍ਹਾ ਨਹੀਂ ਲੱਭ ਰਹੀ ਉਹਨਾਂ ਦੀ ਜੋਬਸ ਘੱਟ ਰਹੀਆਂ ਨੇ ਤੇ ਰੋਬੋਟ ਸੀ ਅੱਜ ਕੱਲ ਸਾਰਾ ਕੰਮ ਕਰ ਰਹੇ ਹਨ ਤੇ ਲੋਕੀ ਬਹੁਤ ਜਿਆਦਾ ਕੰਮ ਕਰਨ ਦੇ ਜਿਹੜੇ ਇੱਛੁੱਕ ਹਨ ਉਹਨਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ ਤੇ ਰੋਬੋਟਸ ਨੇ ਉਹਨਾਂ ਦਾ ਥੋੜਾ ਜਿਹਾ ਨੁਕਸਾਨ ਤੇ ਹਾਂ ਕੀਤਾ ਗਿਆ ਹਰ ਚੀਜ਼ ਵਿੱਚ ਨੁਕਸਾਨ ਤੇ ਹੁੰਦਾ ਹੀ ਆ ਪਰ ਹਾਂ ਇਹ ਹੈ ਕਿ ਪੰਜਾਬ ਨੂੰ ਸਾਡੇ ਇੰਡੀਆ ਨੂੰ ਅੱਗੇ ਤੋਂ ਅੱਗੇ ਜਾਣਾ ਚਾਹੀਦਾ ਹੈ ਤੇ ਇਸ ਟੈਕਨੋਲੋਜੀ ਵਿੱਚ ਸਾਨੂੰ ਬਹੁਤ ਵਧੀ ਜਿਆਦਾ ਲਾਭ ਹੋਏਗਾ ਤੇ ਹਾਂ ਲੋਕੀ ਜਿਹੜੇ ਹੈਗੇ ਆ ਉਹ ਕੰਮ ਕਰਦੇ ਪਏ ਆ ਨੈਚਰਲ ਲੈਂਗੁਏਜ ਪ੍ਰੋਸੈਸਿੰਗ ਤੇ ਕੰਮ ਕਰਦੇ ਪਏ ਆ ਜਿੱਦਾਂ ਕੀ ਹੁਣ ਸਾਨੂੰ ਪਤਾ ਹੈ ਕੀ ਏ ਆਈ ਟੂਲਸ ਨੇ ਏ ਆਈ ਟੂਲ ਵਿੱਚ ਜਿੱਦਾਂ ਆਪਾਂ ਗੂਗਲ ਵਿੱਚ ਬੋਲਦੇ ਆਂ ਤੇ ਗੂਗਲ ਸਾਡੀ ਇੰਗਲਿਸ਼ ਸਮਝਦਾ ਕੀ ਇੰਗਲਿਸ਼ ਦੀ ਭਾਸ਼ਾ ਸਮਝਦਾ ਤੇ ਪੰਜਾਬੀ ਭਾਸ਼ਾ ਨਹੀਂ ਸਮਝਦਾ ਲੋਕੀ ਉਸ ਤੇ ਵੀ ਕੰਮ ਕਰ ਰਹੇ ਨੇ ਤੇ ਦੂਜਾ ਰੋਬੋਟਸ ਦੇ ਕੰਮ ਕਰ ਹੀ ਰਹੇ ਨੇ ਤੇ ਰੋਬੋਟਸ ਦਾ ਮੈਨੂੰ ਲੱਗਦਾ ਹੈ ਕੀ ਰੋਬੋਟ ਸਾਡੀ ਜ਼ਿੰਦਗੀ ਵਿੱਚ ਵਿਚ ਬਹੁਤ ਬਦਲਾਵ ਲਿਆਣਗੇ ਤੇ ਬਹੁਤ ਵੱਡਾ ਪ੍ਰਭਾਵ ਪਏਗਾ ਉਹਨਾਂ ਦਾ ਧੰਨਵਾਦ